ਹੈਲੋ ਨਮਸ਼ਕਾਰ ਜੀ ਮੈਂ ਕੀ ਮਦਦ ਕਰ ਸਕਦੀ ਤੁਹਾਡੀ ਦੱਸੋ ਹਾਂਜੀ ਠੀਕ ਹੈ ਤੁਸੀਂ ਜੇ ਆਪਣੀ ਕੋਠੀ ਦੇ ਵਿੱਚ ਜੇ ਗਾਰਡਨਿੰਗ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਤੁਲਸੀ ਦੇ ਬੂਟੇ ਉਗਾਓ ਧਨੀਏ ਦੇ ਉਗਾਓ ਪੁਦੀਨੇ ਦੇ ਉਗਾਓ ਪੁਦੀਨਾ ਜਿਹੜਾ ਤੁਹਾਡੀ ਸਿਹਤ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਪੁਦੀਨੇ ਦੀ ਚਟਨੀ ਬਣਾਓ ਧਨੀਏ ਦੀ ਚਟਨੀ ਬਣਾਓ ਅਤੇ ਤੁਲਸੀ ਦਾ ਬੂਟਾ ਜਿੱਦਾਂ ਕਿ ਤੁਸੀਂ ਭਗਵਾਨ ਨੂੰ ਭੋਗ ਲਗਾਣਾ ਇੱਕ ਪੱਤਾ ਤੋੜ ਕੇ ਅਤੇ ਤੁਸੀਂ ਉਹਨਾਂ ਦੇ ਭੋਗ ਦੇ ਵਿੱਚ ਲਗਾਓ ਬਹੁਤ ਅੱਛਾ ਰਹੇਗਾ ਤੁਹਾਡੀ ਹੈਲ ਹੈਲਥ ਵਾਸਤੇ ਵੀ ਧਨੀਏ ਪੁਦੀਨੇ ਦੀ ਚਟਨੀ ਬਣਾਓ ਪੁਦੀਨੇ ਧਨੀਏ ਦੀ ਚਟਨੀ ਬਹੁਤ ਹੀ ਅੱਛੀ ਬਣਦੀ ਹੈ ਇਸ ਕਰਕੇ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਐਲੋਵੇਰਾ ਦਾ ਵੀ ਇੱਕ ਬੂਟਾ ਜਰੂਰ ਤੁਸੀਂ ਆਪਣੇ ਘਰ ਵਿੱਚ ਲਗਾਓ ਇਹ ਸਾਰੇ ਜਿਹੜੇ ਬੂਟੇ ਹੈ ਨਾ ਇਹ ਤੁਹਾਡੇ ਗਾਰਡਨਿੰਗ ਦੀ ਸ਼ੋਭਾ ਵਧਾਉਣਗੇ ਠੀਕ ਹੈ ਜੀ ਧੰਨਵਾਦ